ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਤੁਹਾਡੇ ਸਾਰੇ ਜਣਿਆਂ ਦੇ ਨਾਲ ਹੈ ਇਸ ਬਾਰੇ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਵੀ ਜਿਹੜੇ ਬੱਚੇ ਆ ਉਹ ਜਦੋਂ ਸਕੂਲ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ ਅਤੇ ਉਹ ਕਈ ਬੱਚੇ ਜਿਹੜੇ ਆ ਉਹ ਉਚੇਰੀ ਸਿੱਖਿਆ ਜਿਹੜੀ ਅੱਗੇ ਚਲ ਜਾਂਦੇ ਆ ਉਹ ਅੱਗੇ ਪੜ੍ਹਨਾ ਪਸੰਦ ਕਰਦੇ ਆ ਪਰ ਕਈ ਬੱਚੇ ਜਿਹੜੇ ਹੁੰਦੇ ਆ ਉਹ ਨਾਲ ਨਾਲ ਜਿਹੜਾ ਵਾ ਆਪਣੇ ਪਰਿਵਾਰ ਦਾ ਜਿੱਦਾਂ ਕੋਈ ਜਿੱਦਾਂ ਕੋਈ ਬਿਜ਼ਨਸ ਚੱਲਦਾ ਹੁੰਦਾ ਵਾ ਕੋਈ ਕਾਰੋਬਾਰ ਹੁੰਦਾ ਵਾ ਕਿਸੇ ਦਾ ਅਤੇ ਉਹ ਜਿਹੜਾ ਵਾ ਉਹਦੇ ਵਿੱਚ ਨਾਲ ਜੁੱਟ ਜਾਂਦੇ ਆ ਅਤੇ ਨਾਲ ਆਪਣੇ ਮਾਂ ਪਿਓ ਦੇ ਹੱਥ ਹੱਥ ਵਟਾਉਂਦੇ ਆ ਅਤੇ ਜਿਹੜੇ ਕਈ ਲੋਕ ਹੁੰਦੇ ਆ ਉਹ ਜਿਹੜੇ ਆ ਉਹ ਜਿਹੜੇ ਆ ਸਕੂਲੀ ਪੜ੍ਹਾਈ ਤੋਂ ਬਾਅਦ ਨਾਲ ਹੀ ਜਿਹੜਾ ਵਾ ਉਹ ਆਪਣੀ ਕੋਂਪੀਟੀਸ਼ਨ ਦੀ ਤਿਆਰੀ ਕਰਨ ਲੱਗ ਜਾਂਦੇ ਆ ਜਿਹਦੇ ਵਿੱਚ ਜਿਹੜਾ ਕਈ ਪੇਪਰ ਵਗੈਰਾ ਆ ਜਾਂਦੇ ਜਿਹੜੇ ਨੌਕਰੀਆਂ ਦੇ ਲਈ ਜਿਹੜੀ ਸਰਕਾਰੀ ਨੌਕਰੀਆਂ ਦੇ ਲਈ ਬੱਚੇ ਜਿਹੜੇ ਆ ਉਹ ਤਿਆਰੀ ਕਰਨ ਨੂੰ ਜੁੱਟ ਜਾਂਦੇ ਆ ਇਹ ਵੱਖ ਵੱਖ ਬੱਚਿਆਂ ਦਾ ਹਰ ਇੱਕ ਬੱਚੇ ਦਾ ਜਿਹੜਾ ਵਾ ਉਹ ਆਪਣਾ ਰੁਝਾਨ ਹੀ ਹੁੰਦਾ ਵਾ ਵੀ ਉਹ ਇਸ ਤਰ੍ਹਾਂ ਆਪਣਾ ਕਿਸ ਤਰ੍ਹਾਂ ਆਪਣਾ ਜ਼ਿੰਦਗੀ ਨੂੰ ਆਪਣੇ ਵਿੱਚ ਵੇਖਦਾ ਵਾ ਵੀ ਆਪਣਾ ਕੀ ਬਣਨਾ ਚਾਹੁੰਦਾ ਵਾ ਜ਼ਿੰਦਗੀ ਦੇ ਵਿੱਚ ਜੇ ਉਹ ਜਿਸ ਤਰ੍ਹਾਂ ਉਹ ਬੱਚਾ ਸੋਚਦਾ ਵਾ ਉਹ ਉਸ ਤਰ੍ਹਾਂ ਹੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਸਟੈਪ ਵਾਏ ਸਟੈਪ ਜਿਹੜਾ ਵਾ ਉਹ ਅੱਗੇ ਜਿਹੜਾ ਵਾ ਉਹ ਚੱਲਦਾ ਹੀ ਜਾਂਦਾ ਵਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਸਫਲਤਾ ਪ੍ਰਾਪਤ ਕਰਦੇ ਹੀ ਜਾਂਦਾ ਵਾ ਬਾਕੀ ਸਿੱਖਿਆ ਜਿਹੜੀ ਆ ਸਿੱਖਿਆ ਦੇ ਨਾਲ ਨਾਲ ਮੈਂ ਇਹ ਸੋਚਦਾ ਵੀ ਬੱਚੇ ਨੂੰ ਜਿਹੜਾ ਉਹ ਪੜ੍ਹਾਈ ਦੇ ਨਾਲ ਨਾਲ ਹੀ ਥੋੜ੍ਹਾ ਥੋੜ੍ਹਾ ਕੰਮ ਜਿਹੜਾ ਵਾ ਉਹ ਕੋਈ ਇਹੋ ਜਿਹਾ ਸਿੱਖ ਲੈਣਾ ਚਾਹੀਦਾ ਵਾ ਜਿਹੜਾ ਕਿ ਕੋਈ ਟੈਕਨੀਕਲ ਐਜੂਕੇਸ਼ਨ ਆ ਜਾਂਦੀ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਕਿ ਕੋਈ ਇਹੋ ਜਿਹੇ ਕੋਈ ਗੁਣ ਹੱਥ ਵਿੱਚ ਹੋਣਾ ਚਾਹੀਦਾ ਬੱਚੇ ਦੇ ਤਾਂ ਕਿ ਪੜ੍ਹਾਈ ਦੇ ਨਾਲ ਨਾਲ ਜਦੋਂ ਬੱਚਾ ਜਿਹੜਾ ਵਾ ਉਹ ਹੌਲੀ ਹੌਲੀ ਜਿਹੜਾ ਵਾ ਉਹ ਆਪਣੇ ਆਪ 'ਤੇ ਉਹ ਇੰਡੀਪੈਂਡੈਂਟ ਹੋ ਜਾਏ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੈਸੇ ਦੀ ਕੋਈ ਕਮਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੇਕਰ ਕੋਈ ਉਹਦੇ ਹੱਥ ਵਿੱਚ ਗੁਣ ਹੋਵੇਗਾ ਤਾਂ ਕੋਈ ਵੀ ਲੋਕ ਜਾਣਾ ਵਾ ਕਿਸੇ ਵੀ ਕਾਲਜ ਜਾਏਗਾ ਤਾਂ ਹਮੇਸ਼ਾ ਹੀ ਉਹਨੂੰ ਜਿਹੜਾ ਵਾ ਉਹ ਸਾਰੇ ਜਣੇ ਹੱਸ ਕੇ ਸਵੀਕਾਰ ਕਰਨਗੇ ਮੇਰਾ ਤਾਂ ਇਹੀ ਕਹਿਣਾ ਹੈ